ਮੈਨੂੰ ਕਈ ਤਰ੍ਹਾਂ ਦੀਆਂ ਪੇਂਟਿੰਗਾਂ ਪਸੰਦ ਨੇ ਜਿਵੇਂ ਝੋਂਪੜੀ ਦੀ ਪੇਂਟਿੰਗ ਰੁੱਖਾਂ ਦੀ ਪੇਂਟਿੰਗ ਪਹਾੜਾਂ ਦੀ ਪੇਂਟਿੰਗ ਮੈਂ ਸਭ ਤੋਂ ਜ਼ਿਆਦਾ ਵਧੀਆ ਪਹਾੜਾਂ ਦੀ ਪੇਂਟਿੰਗ ਲੱਗਦੀ ਹੈ ਜਦੋਂ ਵੀ ਮੈਂ ਪਹਾੜਾਂ ਦੀ ਪੇਂਟਿੰਗ ਕਰਦਾ ਹਾਂ ਤਾਂ ਉਸ ਦੇ ਕੋਨੇ 'ਚ ਇੱਕ ਸੂਰਜ ਬਣਾਉਂਦਾ ਹਾਂ ਜੋ ਕਿ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਪੇਂਟਿੰਗ ਵਿੱਚ ਪੇਂਟਿੰਗ ਕਰਨ ਤੋਂ ਪਹਿਲਾਂ ਕਲਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਕੋਈ ਪੇਟਿੰਗ ਕਰਦੇ ਹਾਂ ਤਾਂ ਉਸ ਵਿੱਚ ਕਲਰ ਹੋਣ ਤਾਂ ਪੇਂਟਿੰਗ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗਦੀ ਹੈ ਪੇਂਟਿੰਗ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਸਾਫ਼ ਲ ਸਾਫ਼ ਤਰ੍ਹਾਂ ਦੀ ਕੋਪੀ ਜਾਂ ਸਾਫ਼ ਤਰ੍ਹਾਂ ਦਾ ਇ ਦੀ ਪਲੇਟ ਆਉਂਦੀ ਹੈ ਜਿਸ 'ਤੇ ਅਸੀਂ ਪੇਂਟਿੰਗ ਦਰਸਾ ਸਕਦੇ ਹਾਂ ਪੇਂਟਿੰਗ ਨੂੰ ਬੈਠ ਕੇ ਜਾਂ ਖੜ੍ਹ ਕੇ ਬਣਾਇਆ ਜਾ ਸਕਦਾ ਹੈ ਅਤੇ ਰੁੱਖਾਂ ਦੀ ਪੇਂਟਿੰਗ ਵੀ ਬਹੁਤ ਹੀ ਵਧੀਆ ਹੁੰਦੀ ਹੈ ਰੁੱਖਾਂ ਦੀ ਪੇਂਟਿੰਗ ਨੂੰ ਬਣਾਉਣ ਲਈ ਵੀ ਕਲਰਾਂ ਦੀ ਜ਼ਰੂਰਤ ਪੈਂਦੀ ਹੈ ਰੁੱਖਾਂ ਦੀ ਪੇਂਟਿੰਗ ਬਹੁਤ ਹੀ ਵਧੀਆ ਹੁੰਦੀ ਹੈ ਅਤੇ ਰੁੱਖਾਂ ਦੀ ਪੇਂਟਿੰਗ ਵਿੱਚ ਉਪਰਲੇ ਹਿੱਸੇ ਵਿੱਚ ਹਰਾ ਰੰਗ ਭਰਨਾ ਪੈਂਦਾ ਹੈ ਅਤੇ ਹੇਠਲੇ ਹਿੱਸੇ ਵਿੱਚ ਭੂਰਾ ਰੰਗ ਭਰਨਾ ਪੈਂਦਾ ਹੈ ਇਸ ਤਰ੍ਹਾਂ ਰੁੱਖਾਂ ਦੀ ਪੇਂਟਿੰਗ ਤਿਆਰ ਹੋ ਜਾਂਦੀ ਹੈ ਦੂਸਰੀ ਤਰਫ ਜੇ ਦੇਖਿਆ ਜਾਵੇ ਤਾਂ ਮੈਨੂੰ ਸਭ ਤੋਂ ਜ਼ਿਆਦਾ ਝੋਂਪੜੀ ਦੀ ਪੇਂਟਿੰਗ ਵੀ ਬਹੁਤ ਵਧੀਆ ਲੱਗਦੀ ਹੈ ਇਸ ਵਿੱਚ ਵੀ ਕਲਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਕਿਉਂਕਿ ਕੋਈ ਵੀ ਪਿਕਚਰ ਅਸੀਂ ਬਣਾਉਦੇ ਹਾਂ ਤਾਂ ਉਸ ਵਿੱਚ ਰੰਗਾਂ ਦਾ ਭਰਨਾ ਬਹੁਤ ਜ਼ਰੂਰੀ ਹੁੰਦਾ ਹੈ